ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਿਆ ਦਾ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਵ ਹੈ ਜੇਕਰ ਦੇਖਿਆ ਜਾਵੇ ਤਾਂ ਸਿੱਖਿਆ ਨੂੰ ਸਮਾਜ ਵਿੱਚ ਉਤਾਰਨ ਲਈ ਸੱਭਿਆਚਾਰਿਕ ਵਿਰਾਸਤ ਹੀ ਕੰਮ ਆਉਂਦੀ ਹੈ ਸਿੱਖਿਆ ਨੂੰ ਕਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਵਰਤਣਾ ਹੈ ਉਹ ਸੱਭਿਆਚਾਰਕ ਵਿਰਾਸਤ ਹੀ ਉਸ ਨੂੰ ਰਾਹ ਪਾਉਂਦੀ ਹੈ ਸੱਭਿਆਚਾਰਕ ਵਿਰਾਸਤ ਕੀ ਹੈ ਸੱਭਿਆਚਾਰਕ ਵਿਰਾਸਤ ਆਪਣੀ ਮਾਂ ਬੋਲੀ ਤੋਂ ਲੈ ਕੇ ਆਪਣੀ ਲੋਕ ਕਲਾਵਾਂ ਤੱਕ ਜੋ ਅਸੀਂ ਆਪਣੀ ਕਾਰ ਵਿਹਾਰ ਦੇ ਵਿੱਚ ਅਲੱਗ ਅਲੱਗ ਢੰਗ ਨਾਲ ਵਰਤਦੇ ਹਾਂ ਉਹ ਸਾਰੀਆਂ ਚੀਜ਼ਾਂ ਸਾਡੀ ਸੱਭਿਆਚਾਰਕ ਵਿਰਾਸਤ ਹੈ ਹੁਣ ਸੱਭਿਆਚਾਰਕ ਵਿਰਾਸਤ ਜਿਹੜਾ ਸਾਡਾ ਪਿਛੋਕੜ ਆ ਜਿਹੜਾ ਆਪਣਾ ਸਾਡੇ ਪੂਰਵਜ ਨੇ ਪੁਰਾਣੇ ਸਮੇਂ ਤੋਂ ਜਿਹੜੀ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਜਿੱਦਾਂ ਕਿ ਮਿੱਟੀ ਦੇ ਬਰਤਨ ਲੋਕ ਨਾਚ ਭੰਗੜਾ ਗਿੱਧਾ ਹੋਰ ਝੂਮਰ ਹੋਰ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਸੱਭਿਆਚਾਰਿਕ ਵਿਰਾਸਤਾਂ ਨੇ ਅਲੱਗ ਅਲੱਗ ਲੋਕ ਨਾਚ ਨੇ ਅਲੱਗ ਅਲੱਗ ਲੋਕ ਗੀਤ ਨੇ ਅਤੇ ਇਹ ਚੀਜ਼ਾਂ ਜਿਹੜੀਆਂ ਇੱਕ ਮਨੁੱਖ ਨੂੰ ਅਲੱਗ ਤਰੀਕੇ ਨਾਲ ਸੋਚਣਾ ਅਲੱਗ ਤਰੀਕੇ ਨਾਲ ਇੱਕ ਸਮਾਜ ਵਿੱਚ ਵਿਚਰਨ ਦੇ ਕਾਬਿਲ ਬਣਾਉਣ ਦੀਆਂ ਨੇ ਅਤੇ ਉਹਦੀ ਇੱਕ ਉੱਚੀ ਪੱਧਰ ਸੋਚ ਰੱਖ ਸੋਚ ਬਣਾਉਂਦੀਆਂ ਨੇ ਹੁਣ ਸਕੂਲਾਂ ਕਾਲਜਾਂ ਵਿੱਚ ਅਲੱਗ ਅਲੱਗ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਵਧਾ ਵਧਾਉਣ ਲਈ ਕਾਫੀ ਵਧਾਉਣ ਲਈ ਕਾਫੀ ਹੱਦ ਤੱਕ ਪਰਿਆਸ ਕੀਤੇ ਜਾਂਦੇ ਨੇ ਜਿੱਦਾਂ ਕਿ ਯੂਥ ਫੈਸਟ ਹੁੰਦੇ ਨੇ ਜਿਹਦੇ ਵਿੱਚ ਗਿੱਧਾ ਹੁੰਦਾ ਭੰਗੜਾ ਹੁੰਦਾ ਕੰਪਟੀਸ਼ਨ ਵੀ ਹੁੰਦੇ ਆ ਜਿਹਨਾਂ ਵਿੱਚ ਅਲੱਗ ਅਲੱਗ ਬੱਚੇ ਅਲੱਗ ਅਲੱਗ ਆਪਣੀ ਰੁਚੀ ਦੇ ਅਨੁਸਾਰ ਹਿੱਸਾ ਲੈ ਕੇ ਉਹਨਾਂ ਦੇ ਵਿੱਚ ਖਰੇ ਉਤਰਦੇ ਨੇ ਜਿਹਦੇ ਨਾਲ ਉਹਨਾਂ ਨੂੰ ਵੀ ਬਹੁਤ ਹੀ ਸਾਹੀ ਅ ਬਹੁਤ ਹੀ ਸਹੀ ਦਿਸ਼ਾ ਮਿਲਦੀ ਹੈ ਸਹੀ ਕਲਾਵਾਂ ਵਿਕਸਿਤ ਹੁੰਦੀਆਂ ਨੇ ਅਤੇ ਉਹਨਾਂ ਦਾ ਵਿਚਾਰਾਂ ਦੇ ਵਿੱਚ ਵੀ ਵਿਕਾਸ ਹੁੰਦਾ ਹੈ